ਪੰਜਾਬ ਵਿੱਚ ਟੈਕਨਾਲੋਜੀ ਸੈਕਟਰ ਸਥਾਨਕ ਭਾਈਚਾਰੇ ਜਾਂ ਸਮਾਜ ਨਾਲ ਕਾਫ਼ੀ ਹੱਦ ਤੱਕ ਜੁੜਿਆ ਹੋਇਆ ਹੈ ਜਿਸ ਦੀ ਮਦਦ ਦੇ ਨਾਲ ਅਸੀਂ ਗੱਲਬਾਤ ਕਰ ਸਕਦੇ ਹਾਂ ਜਿਵੇਂ ਕਿ ਸਮਾਰਟ ਫੋਨਸ ਸਮਾਰਟ ਲਾਈਟਸ ਸਮਾਰਟ ਪੈੱਨਜ਼ ਹੈੱਡਫੋਨਸ ਜਿਨ੍ਹਾਂ ਦੀ ਮਦਦ ਨਾਲ ਜਿਵੇਂ ਜਿਨ੍ਹਾਂ ਹੈਡਫੋਨ ਜਿਸ ਦੀ ਮਦਦ ਦੇ ਨਾਲ ਜੋ ਚੀਜ਼ ਅਸੀਂ ਖੁਦ ਸੁਣਨਾ ਚਾਹੁੰਦੇ ਹਾਂ ਉਹ ਅਸੀਂ ਦੂਸਰਿਆਂ ਨੂੰ ਨੋਇਜ ਕੈਂਸਲਿੰਗ ਤੋਂ ਬਚਾ ਸਕਦੇ ਹਾਂ ਅਸੀਂ ਹੈਡਫੋਨ ਦੀ ਮਦਦ ਦੇ ਨਾਲ ਅਸੀਂ ਸਿਰਫ ਆਪਣੇ ਵਿਚਾਰਾਂ ਨੂੰ ਖੁਦ ਤੱਕ ਹੀ ਰੱਖ ਸਕਦੇ ਹਾਂ ਸਮਾਰਟ ਪੈੱਨਜ਼ ਅੱਜ ਕੱਲ੍ਹ ਆ ਚੁੱਕੇ ਹਨ ਟੈਕਨੋਲੋਜੀ ਦੇ ਹਿਸਾਬ ਨਾਲ ਉਹਨਾਂ ਦਾ ਵੀ ਸਾਨੂੰ ਕਾਫ਼ੀ ਫ਼ਾਇਦਾ ਹੈ ਜੋ ਕੋਈ ਵੀ ਸਾਡੇ ਕੋਲ ਕੋਈ ਡਾਕੂਮੈਂਟ ਹੈ ਕੋਈ ਕੁਛ ਆ ਉਸ ਨੂੰ ਅਸੀਂ ਰਿਕੋਰਡਿੰਗ ਕਰਕੇ ਸਮਾਰਟ ਪੈੱਨ ਵਿੱਚ ਸੇਵ ਕਰਕੇ ਰੱਖ ਸਕਦੇ ਹਾਂ ਅਤੇ ਉਸ ਤੋਂ ਬਾਅਦ ਉਹਨੂੰ ਵਰਤੋਂ ਦੇ ਤੌਰ 'ਤੇ ਜਿੱਥੇ ਵਰਤਣਾ ਹੋਵੇ ਅਸੀਂ ਸਿਰਫ ਆਪਣੀ ਸੁਵਿਧਾ ਦੇ ਲਈ ਯੂਜ ਕਰ ਸਕਦੇ ਹਾਂ